ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਲਈ ਅੱਜ ਦੇ ਟਾਈਮ ਵਿੱਚ ਕਾਫੀ ਲੋਕ ਆਪਣਾ ਅਹਿਮੀਅਤ ਕਰਨ ਦੇ ਹਨ ਸੋ ਆਪਣਾ ਮਤਲਬ ਕਿ ਯੋਗਦਾਨ ਦੇ ਰਹੇ ਹਨ ਕਿਉਂਕਿ ਅੱਜ ਦੇ ਟਾਈਮ ਵਿੱਚ ਇੱਕ ਅੰਗਰੇਜ਼ੀ ਭਾਸ਼ਾ ਸਾਡੇ ਦੇਸ਼ ਵਿੱਚ ਕਾਫੀ ਵੱਡੀ ਇੱਕ ਚੀਜ਼ ਬਣ ਚੁੱਕੀ ਹਨ ਕਿ ਅਗਰ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤੁਹੀਂ ਅਨਪੜ੍ਹ ਓ ਇਹ ਚੀਜ਼ਾਂ ਅਤੇ ਇਸ ਕਰਕੇ ਲੋਕ ਪੰਜਾਬ ਆਪਣੀ ਜਿਹੜੀ ਭਾਸ਼ਾ ਮੁੱਖ ਭਾਸ਼ਾ ਪੰਜਾਬ ਦੀ ਉਹਨੂੰ ਪਿੱਛੇ ਛੱਡੀ ਜਾਂਦੇ ਹਨ ਅਤੇ ਅੰਗਰੇਜ਼ੀ ਵਾਲੀਆਂ ਕਈ ਹੋਰ ਭਾਸ਼ਾਵਾਂ ਵੱਲ ਜਾਈ ਜਾਂਦੇ ਹਨ ਵੀ ਅੱਜ ਦੇ ਟਾਈਮ 'ਚ ਲੋਕ ਬਾਹਰ ਜਾਣ ਨੂੰ ਕਾਫੀ ਕਰਨ ਦੇ ਹਨ ਅਤੇ ਬਾਹਰ ਜਾਣ ਲਈ ਤੁਹਾਨੂੰ ਅੰਗਰੇਜ਼ੀ ਆਉਣਾ ਕਾਫੀ ਜ਼ਰੂਰੀ ਹੈ ਆਪਣੀ ਜਿਹੜੀ ਭਾਸ਼ਾ ਪੰਜਾਬੀ ਉਹਨੂੰ ਭੁੱਲੀ ਜਾ ਰਹੇ ਹਨ ਅਤੇ ਹੋਰ ਭਾਸ਼ਾ ਨੂੰ ਅਪਣਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਹੈ ਭੁੱਲੀ ਜਾਂਦੇ ਹਨ ਕਿ ਉਹ ਅੱਗੇ ਤਾਂ ਵੱਧ ਜਾਣਗੇ ਪਰ ਜਿਹੜੀ ਉਹਨਾਂ ਦੀ ਆਪਣੀ ਮਲਕੀ ਮਾਤਰ ਆਪਣੇ ਦੀ ਮਾਂ ਬੋਲੀ ਹੈ ਪੰਜਾਬ ਦੀ ਉਹ ਭੁੱਲ ਜਾਣਗੇ ਅਤੇ ਜਿਹੜੀ ਉਹ ਭੁੱਲ ਗਿਆ ਅਤੇ ਉਹ ਮਤਲਬ ਕਿ ਮੰਨ ਲਓ ਕਿ ਅਲੱਗ ਹੀ ਹੋ ਗਿਆ ਪੰਜਾਬ ਤੋਂ ਇਸ ਕਰਕੇ ਹੋਣਾ ਚਾਹੀਦਾ ਹੈ ਕਿ ਲੋਕਾਂ ਨੂੰ ਆਪਣੀ ਪੰਜਾਬੀ ਭਾਸ਼ਾ ਨਹੀਂ ਭੁੱਲਣੀ ਚਾਹੀਦੀ ਅੱਜ ਦੇ ਟਾਈਮ 'ਚ ਕਾਫੀ ਲੋਕ ਕਿੰਨੀ ਕਿੰਨੀ ਲੋਕ ਆਪਣਾ ਮਤਲਬ ਕਿ ਯੋਗਦਾਨ ਦੇ ਰਹੇ ਹਨ ਕਿ ਉਹ ਪੰਜਾਬੀ ਭਾਸ਼ਾ ਨੂੰ ਘਟਾਉਣ ਮਤਲਬ ਕਿ ਖਤਮ ਨਾ ਹੋਣ ਦੇਣ ਅਤੇ ਸਾਨੂੰ ਵੀ ਉਹ ਚੀ ਚੀਜ਼ਾਂ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਅਤੇ ਸਾਨੂੰ ਉਹਦੇ ਵਿੱਚ ਆਪਣਾ ਯੋਗਦਾਨ ਦੇ ਕੇ ਸਾਨੂੰ ਆਪਣੀ ਪੰਜਾਬ ਦੀ ਭਾਸ਼ਾ ਨੂੰ ਘਟਾਉਣਾ ਨਹੀਂ ਚਾਹੀਦਾ ਅਤੇ ਉਹਨੂੰ ਕਾਫੀ ਹੱਦ ਉੱਪਰ ਲੈਵਲ ਤੱਕ ਲੈ ਕੇ ਜਾਣਾ ਚਾਹੀਦਾ ਹੈ ਕਿ ਬਾਹਰਲੇ ਲੋਕ ਵੀ ਕਹਿਣ ਕਿ ਨਹੀਂ ਜੀ ਸਾਨੂੰ ਨਹੀਂ ਲੋੜ ਅੰਗਰੇਜ਼ੀ ਦੀ ਸਾਨੂੰ ਸਿਰਫ ਅੱਛੀ ਲੋਕਾਂ ਦੀ ਲੋੜ ਆ ਜਾਂ ਜਿਹੜਾ ਇਹਨਾਂ ਨੂੰ ਸਮਝ ਆ ਇਹਨਾਂ ਨੂੰ ਕੰਮ ਦੀ ਸਮਝ ਆ ਉਹ ਲੋਕਾਂ ਦੀ ਲੋੜ ਹੈ ਸਿਰਫ